ਪੰਜਾਬ ਵਿੱਚ ਕੁਝ ਇਲਾਕੇ ਇਹੇ ਜਿਹੇ ਹੈ ਜਿੱਥੇ ਅੱਜ ਵੀ ਲੋਕ ਵਹਿਮਾਂ ਭਰਮਾਂ ਤੋਂ ਗ੍ਰਸਤ ਹੈ ਜਿਵੇਂ ਬਿੱਲੀ ਰਸਤਾ ਕੱਟ ਜੇ ਤਾਂ ਕੋਈ ਕੰਮ ਨਹੀਂ ਕਰਨਾ ਛਿੱਕ ਮਾਰ ਜੇ ਤਾਂ ਕੰਮ ਪੂਰਾ ਨਹੀ ਹੋਣਾ ਅਤੇ ਪਿੱਛੋਂ ਅਵਾਜ਼ ਨਹੀਂ ਮਾਰਨੀ ਚਾਹੀਦੀ ਇਹੋ ਜਿਹੇ ਵਹਿਮਾਂ ਭਰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹੈ ਲਿਖਣਾ ਚਾਹੀਦਾ ਹੈ ਤਾਂ ਜੋ ਇਹਨਾਂ ਚੀਜ਼ਾਂ ਤੋਂ ਦੂਰ ਹੋਇਆ ਜਾ ਸਕੇ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਬਈ ਵਹਿਮਾਂ ਵਹਿਮਾਂ ਭਰਮਾਂ 'ਚ ਨਹੀਂ ਪੈਣਾ ਚਾਹੀਦਾ ਇਹ ਤਾਂ ਹੀ ਹੋ ਸਕਦਾ ਜੇ ਆਪਾਂ ਵੱਧ ਤੋਂ ਵੱਧ ਕਿਤਾਬਾਂ ਪੜੂੰਗੇ ਆਪਣਾ ਲਿਟਰੇਚਰ ਪੜੂੰਗੇ ਪੰਜਾਬ ਵਿੱਚ ਪੰਜਾਬ ਦਾ ਜਿਹੜਾ ਲਿਟਰੇਚਰ ਹੈ ਉਹ ਐਨਾ ਜ਼ਿਆਦਾ ਵਧੀਆ ਹੈ ਵੀ ਤੁਸੀਂ ਜੇ ਤੁਸੀਂ ਇਹ ਪੜ੍ਹਨਾ ਸ਼ੁਰੂ ਕਰੋ ਤਾਂ ਇਹਨਾਂ ਵਰਮਾਂ ਭਰਮਾਂ ਵਿੱਚ ਬੰਦਾ ਪਊਗਾ ਹੀ ਨਹੀਂ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਇਹਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਵੀ ਇਹਨਾਂ ਵਰਮਾ ਵਹਿਮਾਂ ਭਰਮਾਂ ਵਿੱਚ ਨਾ ਪਿਆ ਜਾਵੇ ਤਾਂ ਜੋ ਪੰਜਾਬ ਦੀ ਤਰੱਕੀ ਹੋ ਸਕੇ